ਭੰਗੜਾ ਪੰਜਾਬ ਦਾ ਇੱਕ ਲੋਕ ਨਾਚ ਬਹੁਤ ਵਧੀਆ ਹੈਗਾ ਜਿਹਦੇ ਨਾਲ ਮਨੋਰੰਜਨ ਵੀ ਹੋ ਜਾਂਦਾ ਬੰਦਾ ਸਿਹਤਯਾਬ ਵੀ ਰਹਿੰਦਾ ਅਤੇ ਹੋਰ ਭੰਗੜੇ ਦੇ ਵਿੱਚ ਮਤਲਬ ਇੰਨਾ ਗਰੁੱਪ ਦੇ ਵਿੱਚ ਲੋਕ ਮਨੋਰੰਜਨ ਕਰਦੇ ਆ ਲੋਕ ਦੇਖਦੇ ਆ ਔਰ ਭੰਗੜਾ ਪਾਉਂਦੇ ਆ ਬੋਲੀਆਂ ਪਾਉਂਦੇ ਆ ਅਤੇ ਲੋਕ ਨੱਚਦੇ ਟੱਪਦੇ ਆ ਅਤੇ ਬਹੁਤ ਵਧੀਆ ਹੈਗਾ ਭੰਗੜਾ ਮਤਲਬ ਇੱਕ ਬਹੁਤ ਹੀ ਵਧੀਆ ਸਿਹਤ ਦਿਮਾਗੀ ਔਰ ਚੁਸਤੀ ਫ਼ੁਰਤੀ ਸਰੀਰ ਨੂੰ ਲੈ ਕੇ ਆਉਂਦਾ ਜਿਵੇਂ ਪੰਮੀ ਬਾਈ ਹੈਗਾ ਜਿਹੜਾ ਭੰਗੜੇ ਦਾ ਮਤਲਬ ਹੈਗਾ ਬਹੁਤ ਇੱਕ ਸੁਪਰਸਟਾਰ ਹੈ ਬਹੁਤ ਵਧੀਆ ਇਹਨਾਂ ਲੋਕਾਂ ਨੂੰ ਜਾਣਕਾਰੀ ਦਿੱਤੀ ਉਹ ਲੋਕਾਂ ਨੂੰ ਜਾਗਰੁਕ ਕੀਤਾ ਔਰ ਭੰਗੜਾ ਬਹੁਤ ਹੀ ਅਸੀਂ ਕਹਿੰਦੇ ਹਾਂ ਬਹੁਤ ਹੀ ਵਧੀਆ ਹੈਗਾ ਭੰਗੜੇ ਨਾਲ ਮਨੋਰੰਜਨ ਵੀ ਸਿਹਤਯਾਬੀ ਸਭ ਕੁਛ ਹੈ ਸਿਹਤਯਾਬੀ ਮਿਲਦੀ ਹੈ ਸਾਰਾ ਕੁਛ ਹੈ ਔਰ ਭੰਗੜਾ ਇੱਕ ਦੇ ਇੱਕ ਇੰਨੀ ਪਰੰਪਰਾ ਹੈਗੀ ਬਹੁਤ ਪੁਰਾਣੀ ਪਰੰਪਰਾ ਔਰ ਜੋ ਉਹ ਹੋਣੀ ਜ਼ਰੂਰੀ ਆ ਉਹ ਅੱਜ ਕੱਲ੍ਹ ਲੋਕ ਭੰਗੜੇ ਬਾਰੇ ਸਭ ਕੁਝ ਕੁਝ ਭੁੱਲਗੇ ਅਤੇ ਭੰਗੜੇ ਵਾਲੀ ਜਿਹੜੀ ਪੁਰਾਣੀ ਰੋ ਜਦੋਂ ਲੋਕ ਪਾਉਂਦੇ ਆ ਬੱਚੇ ਨਹੀਂ ਸਮਝਦੇ ਵੀ ਭੰਗੜਾ ਵੀ ਹਾਂ ਕੋਈ ਚੀਜ਼ ਸੀ ਪਹਿਲਾਂ ਸੀ ਹੁਣ ਲੋਕ ਇਹ ਚੀਜ਼ ਸਮਝਦੇ ਆ